ਸਾਡੀ ਰਸੋਈ ਵਿੱਚ ਬਿਜਲੀ ਦੇ ਕਈ ਉਪਕਰਨ ਹਨ ਜਿਵੇਂ ਕਿ ਪਹਿਲੇ ਛੋਟੇ ਹੁੰਦੇ ਸਾਡੇ ਘਰਾਂ ਵਿੱਚ ਅੰਗੀਠੀ ਬਲਦੀ ਸੀ ਮਿੱਟੀ ਦੇ ਤੇਲ ਵਾਲੇ ਸਟੋਵ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਮਸਾਲਾ ਪੀਸਣ ਲਈ ਡੋਰੀ ਡੰਡਾ ਅਤੇ ਸਿਲਵੱਟਾ ਹੁੰਦਾ ਸੀ ਅਤੇ ਲੋਕ ਪੁਰਾਣੇ ਸਮੇਂ ਵਿੱਚ ਕਈ ਕਈ ਦੇਰ ਤੱਕ ਚੁੱਲ੍ਹੇ 'ਤੇ ਖਾਣਾ ਪਕਾਉਂਦੇ ਸਨ ਪਰ ਸਮੇਂ ਦੀ ਤਬਦੀਲੀ ਨਾਲ ਹੁਣ ਸਾਡੇ ਘਰਾਂ ਵਿੱਚ ਓਵਨ ਮਿਕਸੀ ਜੂਸਰ ਫੂਡ ਪ੍ਰੋਸੈਸਰ ਆਦਿ ਦੀ ਵਰਤੋਂ ਕੀਤੀ ਗਈ ਹੈ ਅਤੇ ਕਾਫ਼ੀ ਤਬਦੀਲੀਆਂ ਹੋਣ ਨਾਲ ਹੁਣ ਸਮੇਂ ਦੀ ਵੀ ਬਚਤ ਹੋ ਗਈ ਹੈ ਅਤੇ ਤੇਜ਼ੀ ਨਾਲ ਸਮਾਜ ਵਿੱਚ ਵੀ ਬਦਲਾਅ ਹੋ ਰਿਹਾ ਹੈ